ਪਹਿਲੇ ਸਮੇਂ ਵਿੱਚ ਸਕੂਲਾਂ ਦਾ ਪੱਧਰ ਬਹੁਤ ਨੀਵਾਂ ਹੁੰਦਾ ਸੀ ਅਤੇ ਹੁਣ ਦੇ ਸਮੇਂ ਵਿੱਚ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੋ ਹੋ ਗਿਆ ਹੈ ਪਹਿਲੇ ਸਮੇਂ ਵਿੱਚ ਸਕੂਲਾਂ ਵਿੱਚ ਟਾਟ ਹੁੰਦੇ ਸੀ ਅਤੇ ਬੱਚਿਆਂ ਨੂੰ ਹੇਠ ਬੈਠਣਾ ਪੈਂਦਾ ਸੀ ਅਤੇ ਹੁਣ ਦੇ ਸਮੇਂ ਵੀ ਸਕੂਲਾਂ ਵਿੱਚ ਬੈਂਚ ਆ ਗਏ ਹਨ ਅਤੇ ਬੱਚੇ ਬੈਂਚਾਂ 'ਤੇ ਬੈਠਦੇ ਹਨ ਪਹਿਲੇ ਸਮੇਂ ਵਿੱਚ ਸਕੂਲਾਂ ਵਿੱਚ ਟੀਚਰ ਬਹੁਤ ਘੱਟ ਹੁੰਦੇ ਸੀ ਅਤੇ ਪੜ੍ਹਾਈ ਬਹੁਤ ਘੱਟ ਹੁੰਦੀ ਸੀ ਅਤੇ ਹੁਣ ਦੇ ਸਮੇਂ ਵਿੱਚ ਸਕੂਲਾਂ ਵਿੱਚ ਟੀਚਰ ਬਹੁਤ ਹਨ ਅਤੇ ਪੜ੍ਹਾਈ ਵੀ ਬਹੁਤ ਵਧੀਆ ਹੋ ਰਹੀ ਹੈ ਆਵਾਜਾਈ ਆਵਾਜਾਈ ਵਿੱਚ ਬਹੁਤ ਸਾਧਨ ਹਨ ਜਿਵੇਂ ਕਿ ਕਾਰਾਂ ਮੋਟਰਸਾਈਕਲ ਟ੍ਰੇਨਾਂ ਬੱਸਾਂ ਹਵਾਈ ਜਹਾਜ਼ ਮਨੋਰੰਜਨ ਮਨੋਰੰਜਨ ਵਿੱਚ ਪਹਿਲੇ ਸਮੇਂ ਵਿੱਚ ਮਨੋਰੰਜਨ ਨਹੀਂ ਹੁੰਦੇ ਸੀ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਮਨੋਰੰਜਨ ਦੇ ਸਾਧਨ ਆ ਗਏ ਹਨ ਜਿਵੇਂ ਕਿ ਸਿਨੇਮਾ ਘਰ ਟੀਵੀ ਮੋਬਾਇਲ ਫ਼ੋਨ ਆਦਿ ਸਿਹਤ ਵਿੱਚ ਬਹੁਤ ਸਾਰਾ ਸੁਧਾਰ ਹੋਇਆ ਹੈ ਕਿਉਂਕਿ ਬਹੁਤ ਸਾਰੇ ਹਸਪਤਾਲ ਖੁੱਲ੍ਹ ਗਏ ਹਨ